ਸਤਿ ਸ਼੍ਰੀ ਅਕਾਲ ਜੀ ਅਸੀਂ ਆਪਣੇ ਬਚਪਨ ਦੀਆਂ ਖੇਡਾਂ ਬਾਰੇ ਬਹੁਤ ਸਾਰੀਆਂ ਯਾਦਾਂ ਹੈ ਹਨਾ ਹਰੇਕ ਦੇ ਜੀਵਨ ਨਾਲ ਜੁੜੀਆਂ ਹੁੰਦੀਆਂ ਜਿਵੇਂ ਬਹੁਤ ਸਾਰਾ ਕੁਛ ਗਲੀਆਂ ਵਿੱਚ ਬਹੁਤ ਸਾਰੇ ਬੱਚੇ ਇਕੱਠੇ ਹੋ ਕੇ ਖੇਡਦੇ ਸੀਗੇ ਜਿਵੇਂ ਕਿ ਲੁਕਣ ਮੀਚੀ ਖੇਡਣਾ ਭੱਜਾ ਭਜਾਈ ਖੇਡਦੇ ਕੈਂਪਾ ਕੋਲਾ ਖੇਡਦੇ ਬਹੁਤ ਸਾਰੀਆਂ ਜਿਹੜੀਆਂ ਇੱਦਾਂ ਦੀਆਂ ਗੁਲੀ ਡੰਡਾ ਖੋ ਖੋ ਇਹ ਸਾਰੀਆਂ ਖੇਡਾਂ ਅਸੀਂ ਸਾਰੇ ਬੱਚੇ ਇਕੱਠੇ ਹੋ ਕੇ ਖੇਡਦੇ ਹੁੰਦੇ ਅਤੇ ਬੜਾ ਮਜ਼ਾ ਆਉਂਦਾ ਹੁੰਦਾ ਹੈ ਨਾ ਅਤੇ ਅੱਜ ਦੇ ਟਾਈਮ 'ਚ ਬੱਚੇ ਖੇਡਦੇ ਆ ਬਹੁਤ ਘੱਟ ਖੇਡਦੇ ਮਤਲਬ ਜਿੰਨਾ ਅਸੀਂ ਖੇਡਦੇ ਸੀ ਉਸ ਨਾਲੋਂ ਘੱਟ ਖੇਡਦੇ ਕਿਉਂਕਿ ਅੱਜ ਦੇ ਟਾਈਮ 'ਚ ਜਿਹੜੇ ਬੱਚੇ ਆ ਨਾ ਉਹ ਫੋਨਾਂ ਦਾ ਯੂਜ ਜਿਹੜਾ ਵੱਧ ਕਰਦੇ ਆ ਅਤੇ ਖੇਡਾਂ ਦਾ ਯੂਜ ਘੱਟ ਕਰਦੇ ਆ ਅਤੇ ਮੈਨੂੰ ਲੱਗਦਾ ਵੀ ਪੇਰੈਂਟਸ ਨੂੰ ਇਹਨਾਂ ਮਾਂ ਪਿਓ ਨੂੰ ਜਿਹੜੀਆਂ ਗੱਲਾਂ ਧਿਆਨ ਰੱਖਣਾ ਚਾਹੀਦਾ ਹੈਗਾ ਵੀ ਉਹ ਬੱਚਿਆਂ ਨੂੰ ਹੈ ਨਾ ਖੇਡਾਂ ਵਿੱਚ ਪਾਉਣ ਜਿਵੇਂ ਕਿ ਲੁੱਕਣ ਮੀਚੀ ਆ ਫੜਨ ਫੜੀਚੀ ਆ ਦੋ ਘੰਟੇ ਤਾਂ ਦਿਨ 'ਚ ਖੇਡਣਾ ਚਾਹੀਦਾ ਬਟ ਅਸੀਂ ਆਪਣੇ ਟਾਈਮ 'ਚ ਬਹੁਤ ਖੇਡਦੇ ਹੁੰਦੇ ਸੀ ਸਾਰਾ ਦਿਨ ਹੀ ਖੇਡੀ ਜਾਂਦਾ ਸਕੂਲ 'ਤੇ ਵੀ ਖੇਡਣਾ ਅੱਧੀ ਛੁੱਟੀ ਵੇਲੇ ਵੀ ਖੇਡਣਾ ਘਰ ਆ ਕੇ ਵੀ ਪਹਿਲਾਂ ਖੇਡਣਾ ਹੁੰਦਾ ਅੱਜ ਦੇ ਟਾਈਮ 'ਚ ਬੱਚੇ ਬਹੁਤ ਘੱਟ ਖੇਡਣ ਲੱਗ ਗਏ ਉਹ ਪਹਿਲਾਂ ਤਾਂ ਮਿਲ ਕੇ ਇਕੱਠੇ ਖੇਡਦੇ ਨਹੀਂ ਹੈਗੇ ਅਤੇ ਅਸੀਂ ਸਾਰੇ ਤਾਏ ਚਾਚਿਆਂ ਦੇ ਜਵਾਕ ਇਕੱਠੇ ਹੁੰਦੇ ਅਤੇ ਉਹ ਇੰਨਾ ਨਹੀਂ ਇਕੱਠੇ ਹੁੰਦੇ ਹੈਗੇ ਉਹ ਤਾਂ ਬਸ ਇਕੱਲੇ ਇਕੱਲੇ ਹੈਗੇ ਆ ਘਰਾਂ 'ਚ ਅਤੇ ਉਹ 'ਚ ਵੀ ਬਸ ਉਹ ਫੋਨਾਂ ਜੋਗੇ ਹੀ ਰਹਿ ਗਏ ਹਨ ਅਤੇ ਪਰ ਇਹ ਸਾਰੀਆਂ ਚੀਜ਼ਾਂ ਮਾਪਿਆਂ ਨੂੰ ਚਾਹੀਦੀਆਂ ਵੀ ਸਾਨੂੰ ਸਹੀ ਕਰਨੀਆਂ ਚਾਹੀਦੀਆਂ ਜਿਹੜੇ ਬੱਚਿਆਂ ਨੂੰ ਵੱਧ ਤੋਂ ਵੱਧ ਹੈ ਨਾ ਖੇਡਣ ਵਿੱਚ ਲਾਉਣਾ ਚਾਹੀਦਾ ਥੈਂਕ ਯੂ